ਮੋਹਾਲੀ ਜ਼ਿਲ੍ਹੇ ਵਿੱਚ ਕੁਝ ਮਹੱਤਵਪੂਰਨ ਸਥਾਨ ਜਾਂ ਇਤਿਹਾਸਿਕ ਅਸਥਾਨ ਹਨ ਜਿਵੇਂ ਕਿ ਮੰਦਰ ਕਿਲ੍ਹੇ ਅਜਾਇਬ ਘਰ ਕੁਦਰਤੀ ਵਿਸ਼ੇਸ਼ਤਾਵਾਂ ਆਦਿ ਕੁਰਾਲੀ ਸ਼ਹਿਰ ਵਿਖੇ ਇੱਕ ਪ੍ਰਸਿੱਧ ਮਾਤਾ ਸ਼ੀਤਲਾ ਜੀ ਦਾ ਮੰਦਰ ਹੈ ਮਾਤਾ ਸ਼ੀਤਲਾ ਜੀ ਦੇ ਮੰਦਰ ਵਿੱਚ ਬਹੁਤ ਹੀ ਬਹੁਤ ਹੀ ਵੱਡਾ ਤਿਉਹਾਰ ਮਨਾਇਆ ਜਾਂਦਾ ਹੈ ਇਸ ਦਿਨ ਘਰ ਘਰ ਵਿੱਚ ਗੁਲਗੁਲੇ ਕਚੌਰੀਆਂ ਪਕਾਈਆਂ ਜਾਂਦੀਆਂ ਹਨ ਇਹ ਮੇਲਾ ਬਹੁਤ ਹੀ ਪ੍ਰਸਿੱਧ ਅਤੇ ਵੱਡਾ ਮੰਨਿਆ ਜਾਂਦਾ ਹੈ ਮੋਹਾਲੀ ਜ਼ਿਲ੍ਹੇ ਵਿੱਚ ਕੁਦਰਤੀ ਵਿਸ਼ੇਸ਼ਤਾਵਾਂ ਜਿਵੇਂ ਕਿ ਸ਼ਿਵਾਲਿਕ ਪਹਾੜੀਆਂ ਸਿਸਵਾਂ ਡੈਮ ਸੁਖਨਾ ਲੇਕ ਆਦਿ ਵੀ ਸਥਿਤ ਹਨ ਸੁਖਨਾ ਲੇਕ ਦੇ ਮੋਹਾਲੀ ਦੇ ਕਰੀਬ ਹੋਣ ਕਾਰਨ ਸੈਲਾਨੀਆਂ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਹੈ ਮੋਹਾਲੀ ਵਿੱਚ ਬਹੁਤ ਹੀ ਪ੍ਰਸਿੱਧ ਗੁਰਦੁਆਰਾ ਸਾਹਿਬ ਵੀ ਸਥਿਤ ਹਨ ਜਿਵੇਂ ਕਿ ਸਿੰਘ ਸ਼ਹੀਦਾਂ ਸੋਹਾਣਾ ਸਾਹਿਬ ਗੁਰਦੁਆਰਾ ਬਹੁਤ ਹੀ ਪ੍ਰਸਿੱਧ ਅਤੇ ਪ੍ਰਾਚੀਨ ਮੰਨਿਆ ਜਾਂਦਾ ਹੈ